ਨਵੇਂ ਜਨਮੇ ਬੱਚੇ ਬੱਚਿਆਂ ਦੀ ਦੇਖਭਾਲ ਵਿੱਚ ਉਸਦੇ ਸਰੀਰ ਮੁਤਾਬਿਕ ਉਸਨੂੰ ਖ਼ੁਰਾਕ ਦੇਣੀ ਚਾਹੀਦੀ ਹੈ ਉਸਨੂੰ ਸਮੇਂ ਸਿਰ ਇੰਜੈਕਸ਼ਨ ਦਿਵਾਉਣ ਲਈ ਦਿਵਾਉਣੇ ਚਾਹੀਦੇ ਹਨ ਜਿਸ ਕਾਰਨ ਉਸਨੂੰ ਕੋਈ ਵੀ ਬਿਮਾਰੀ ਨੇੜੇ ਨਾ ਲੱਗੇ ਅਤੇ ਉਸਨੂੰ ਬਾਹਰ ਵੀ ਘੱਟ ਹੀ ਲੈ ਕੇ ਜਾਣਾ ਚਾਹੀਦਾ ਹੈ ਤਾਂ ਕਿ ਬਾਹਰ ਦੀ ਗੰਦੀ ਹਵਾ ਉਸਦੇ ਨੇੜੇ ਨਾ ਲੱਗੇ ਅਤੇ ਉਸਨੂੰ ਪੋਲੀਓ ਦੇ ਡਰੋਪਸ ਜਾਂ ਪੋਲੀਓ ਦੇ ਇੰਜੈਕਸ਼ਨ ਦਿਵਾਉਣੇ ਚਾਹੀਦੇ ਹਨ ਕਿਉਂਕਿ ਇਹ ਬਿਮਾਰੀ ਬਹੁਤ ਸਾਲ ਪਹਿਲਾਂ ਆਈ ਸੀ ਜੋ ਕਿ ਛੋਟੇ ਬੱਚਿਆਂ ਵਿੱਚ ਜ਼ਿਆਦਾਤਰ ਸੀ ਅਤੇ ਜਨਮ ਲੈਣ ਤੋਂ ਬਾਅਦ ਛੇ ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ ਅਤੇ ਉਸ ਤੋਂ ਛੇ ਮਹੀਨੇ ਬਾਅਦ ਬੱਚੇ ਨੂੰ ਹਲਕਾ ਭੋਜਨ ਹੀ ਦੇਣਾ ਚਾਹੀਦਾ ਹੈ ਜਿਵੇਂ ਕਿ ਬਿਸਕਿਟ ਜਾਂ ਨਮਕੀਨ ਆਦਿ ਦੇਣੇ ਚਾਹੀਦੇ ਹਨ